ਸਾਡੇ ਇਲਾਕੇ ਵਿੱਚ ਪ੍ਰਾਈਵੇਟ ਅਤੇ ਸਰਕਾਰੀ ਦੋਨੋਂ ਤਰੀਕੇ ਦੇ ਬੈਂਕ ਨੇ ਪ੍ਰਾਈਵੇਟ ਸੈਕਟਰ ਦੇ ਜ਼ਿਆਦਾ ਫੇਮਸ ਬੈਂਕਸ ਜੋ ਨੇ ਉਹ ਐੱਚ ਡੀ ਐੱਫ ਸੀ ਅਤੇ ਆਈ ਸੀ ਆਈ ਸੀ ਆਈ ਨੇ ਅਤੇ ਸਰਕਾਰੀ ਐੱਸ ਬੀ ਆਈ ਬੈਂਕ ਜੋ ਹੈ ਉਹ ਸਭ ਤੋਂ ਫੇਮਸ ਹੈ ਲੋਕਾਂ ਦੇ ਦਿਮਾਗ਼ ਵਿੱਚ ਇਹ ਇੱਕ ਈਮੇਜ ਬਣੀ ਹੋਈ ਹੈ ਕਿ ਜੋ ਪ੍ਰਾਈਵੇਟ ਬੈਂਕ ਨੇ ਉਸ ਵਿੱਚ ਹਰ ਕੰਮ ਜੋ ਹੈ ਉਹ ਜਲਦੀ ਅਤੇ ਸਹੀ ਤਰੀਕੇ ਨਾਲ਼ ਕੀਤਾ ਜਾਂਦਾ ਹੈ ਅਤੇ ਸਰਕਾਰੀ ਬੈਂਕਸ ਦੇ ਵਿੱਚ ਇੱਕ ਕਾਊਂਟਰ ਤੋਂ ਦੂਸਰੇ ਕਾਊਂਟਰ ਤੱਕ ਹੀ ਇਨਸਾਨ ਦੀ ਦੌੜ ਲਵਾਉਂਦੇ ਰਹਿੰਦੇ ਨੇ ਅਤੇ ਕੋਈ ਕੰਮ ਸਹੀ ਤਰੀਕੇ ਨਾਲ਼ ਨਹੀਂ ਕਰਦੇ ਇਹ ਈਮੇਜ ਜੋ ਹੈ ਕੁਛ ਹੱਦ ਤੱਕ ਸਹੀ ਵੀ ਸੀ ਕਿਸੇ ਸਮੇਂ ਤੱਕ ਕਿ ਸਰਕਾਰੀ ਬੈਂਕਸ ਦੇ ਵਿੱਚ ਚੰਗੀ ਤਰ੍ਹਾਂ ਕੰਮ ਨਹੀਂ ਸੀ ਹੁੰਦਾ ਬਟ ਸਰਕਾਰ ਦੀ ਕੀਤੀ ਗਈ ਸਖ਼ਤੀ ਅਤੇ ਬੈਂਕਸ ਦੇ ਮਰਜਰ ਕਰਨ ਦੇ ਨਾਲ਼ ਸਰਕਾਰੀ ਬੈਂਕਸ ਜੋ ਨੇ ਉਹ ਵੀ ਹੁਣ ਸਹੀ ਤਰੀਕੇ ਨਾਲ਼ ਕੰਮ ਕਰਨ ਲੱਗ ਗਏ ਨੇ ਅਤੇ ਪ੍ਰਾਈਵੇਟ ਬੈਂਕਸ ਦੀ ਤਰ੍ਹਾਂ ਹੀ ਸਰਕਾਰੀ ਬੈਂਕਸ ਦੇ ਵਿੱਚ ਵੀ ਹਰ ਫੈਸਿਲਿਟੀ ਜੋ ਹੈ ਉਹ ਮਿਲਦੀ ਹੈ ਸਰਕਾਰੀ ਬੈਂਕ ਜੋ ਨੇ ਉਹ ਪ੍ਰਾਈਵੇਟ ਬੈਂਕ ਦੇ ਕੰਪੈਰੇਟਿਵਲੀ ਲੋਕਾਂ ਨੂੰ ਜ਼ਿਆਦਾ ਸੇਫ਼ ਲੱਗਦੇ ਨੇ ਲੋਨ ਲੈਣ ਲਈ ਜਾਂ ਫਿਰ ਆਪਣਾ ਅਕਾਊਂਟ ਖੁਲਵਾਉਣ ਲਈ ਕਿਉਂਕਿ ਰੇਟ ਔਫ਼ ਇੰਟਰਸਟ ਜੋ ਹੈ ਉਹ ਸਰਕਾਰੀ ਬੈਂਕ ਦੇ ਵਿੱਚ ਪ੍ਰਾਈਵੇਟ ਬੈਂਕ ਨਾਲੋਂ ਘੱਟ ਹੁੰਦਾ ਹੈ ਅਤੇ ਸ ਸਰਕਾਰੀ ਬੈਂਕ ਤੋਂ ਲੋਨ ਲੈਣਾ ਜੋ ਹੈ ਉਹ ਪ੍ਰਾਈਵੇਟ ਬੈਂਕ ਨਾਲੋਂ ਜ਼ਿਆਦਾ ਲਾਭਦਾਇਕ ਰਹਿੰਦਾ ਹੈ ਮੈਂ ਵੀ ਸਰਕਾਰੀ ਬੈਂਕ ਨੂੰ ਹੀ ਪ੍ਰਾਈਵੇਟ ਬੈਂਕ ਦੀ ਥਾਂ 'ਤੇ ਪ੍ਰੈਫਰ ਕਰਦੀ ਹਾਂ